ਯੋਗਾ ਵਿੱਚ ਮੇਰਾ ਮਨ ਪਸੰਦ ਜੋ ਹੈ ਕਪਾਲਭਾਤੀ ਅਤੇ ਅਲੋਮ ਬਿਲੋਮ ਹੈ ਕਿਉਂਕਿ ਸਾਡੀ ਸਾਹ ਲੈਣ ਦੀ ਪ੍ਰਕਿਰਿਆ ਨੂੰ ਬੜਾ ਮਜ਼ਬੂਤ ਕਰਦਾ ਹੈ ਅਤੇ ਉਸਦੇ ਨਾਲ ਸਾਡੇ ਫੇਫੜੇ ਵੀ ਮਜ਼ਬੂਤ ਹੋ ਜਾਂਦੇ ਨੇ ਅਤੇ ਇਸ ਵਿੱਚ ਅੱਗੇ ਸਾਰਾ ਲਾਈ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਬੜਾ ਅੱਛੀ ਤਰ੍ਹਾਂ ਕਰ ਸਕਦਾ ਹਾਂ ਕੰਮ ਕਾਰ ਕਰਮ ਔਰ ਇਸ ਤੋਂ ਇਲਾਵਾ ਵੀ ਸੂਰਜ ਨਮਸਕਾਰ ਜਿਹੜਾ ਹੈ ਉਸ ਦੇ ਵਿੱਚ ਸ ਯੋਗਾ ਦਾ ਪ੍ਰਕਿਰਿਆ ਅਲੱਗ ਅਲੱਗ ਕਿਰਿਆ ਹੁੰਦੀਆਂ ਐਕਸਰਸਾਈਜ਼ ਹੈ ਜਿਹਨਾਂ ਦੇ ਨਾਲ ਪੂਰੇ ਬੋਡੀ ਦੇ ਵਿੱਚ ਪੂਰੀ ਬਾਡੀ ਦੇ ਵਿੱਚ ਐਨਰਜੀ ਬਣਦੀ ਹੈ ਤਾਂ ਜੋ ਮੈਨੂੰ ਆਪਣਾ ਦਿਨ ਦਾ ਕਾਰਜ ਕਾਰਜ ਕੰਮ ਕਾਰ ਕਰਨ ਲਈ ਪੂਰੀ ਐਨਰਜੀ ਦਿੰਦਾ ਹੈ ਅਤੇ ਉਸਦੇ ਵਿੱਚ ਮੈਂ ਫਿਰ ਅੱਛੀ ਤਰ੍ਹਾਂ ਆਪਣਾ ਟਾਈਮ ਟਾਈਮ ਔਰ ਲਾਈਵ ਦਾ ਦਿਨ ਦਾ ਟਾਈਮ ਪ੍ਰੋਗਰਾਮ ਅੱਛੀ ਤਰ੍ਹਾਂ ਵਿਦਾ ਬਿਤਾਉਂਦਾ ਹਾਂ ਇਸ ਤੋਂ ਇਲਾਵਾ ਵੀ ਕੁਛ ਯੋਗਾ ਦੀਆਂ ਜੋ ਐਕਸਰਸਾਈਜ਼ਾਂ ਹੈ ਜਿਵੇਂ ਬੱਦਰੀ ਬੱਦਰੀ ਕਾ ਆਸਣ ਹੈ ਬ ਔਰ ਔਰ ਬਾਕੀ ਐਕਸਰਸਾਈਜ਼ਾਂ ਵੀ ਲਗਾਤਾਰ ਮੈਂ ਇਸ ਵਿੱਚ ਟੱਚ 'ਚ ਰਹਿੰਦਾ ਹਾਂ ਔਰ ਲਾਈਫ ਦਾ ਬਹੁਤ ਬਹੁਤ ਸ਼ੁਰੂ ਤੋਂ ਇਹ ਮੈਂ ਯੋਗਾ ਐਕਸਸਾਈਜ਼ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਦਾ ਬੈਨੀਫਿਟ ਮੈਨੂੰ ਹਾਲੇ ਤੱਕ ਮਿਲ ਰਿਹਾ ਹੈ